ਅਸੀਂ ਵੱਖ ਵੱਖ ਕੱਪੜਿਆਂ ਨੂੰ ਵੱਖ ਵੱਖ ਤਰੀਕੇ ਦੇ ਨਾਲ ਧੋਂਦੇ ਹਾਂ ਜਿਵੇਂ ਕਿ ਜੋ ਭਾਰੇ ਕੰਬਲ ਵਗੈਰਾ ਸਾਡੇ ਕੋਲ ਨਹੀਂ ਧੋਤੇ ਜਾਂਦੇ ਉਹਨਾਂ ਨੂੰ ਅਸੀਂ ਡਰੈ ਕਲੀਨ ਲਈ ਦਿੱਤੇ ਦਿੰਦੇ ਹਾਂ ਜਿਹੜੇ ਪਾਰਟੀ ਵੇਅਰ ਗਾਉਨ ਪੈਂਟ ਕੋਟ ਉਹ ਵੀ ਅਸੀਂ ਘਰ ਨਹੀਂ ਧੋਂਦੇ ਉਹਨੂੰ ਵੀ ਅਸੀਂ ਡਰਾਈ ਕਲੀਨ ਲਈ ਦਈਦੇ ਆ ਅਤੇ ਬਾਕੀ ਜਿਹੜੇ ਨਾਰਮਲ ਰੂਟੀਨ ਦੇ ਕੱਪੜੇ ਆ ਉਹ ਅਸੀਂ ਮਸ਼ੀਨ 'ਚ ਸਰਫ ਪਾ ਕੇ ਪਾਣੀ ਪਾ ਕੇ ਉਸਨੂੰ ਇੱਕ ਗੇੜਾ ਦਵਾ ਕੇ ਫਿਰ ਇਹਨੂੰ ਨਿਤਾਰ ਕੇ ਸਪਿਨਰ 'ਚ ਪਾ ਕੇ ਸੁਕਾ ਕੇ ਫਿਰ ਅਸੀਂ ਉਹਨੂੰ ਕੋਠੇ ਛੱਤ 'ਤੇ ਸੁੱਕਣੇ ਪਾ ਆਉਂਦੇ ਹਾਂ ਬਾਕੀ ਜਿਹੜੇ ਹੁੰਦੇ ਆ ਸਾਡੇ ਪਾਰਟੀ ਵੇਅਰ ਦੂਸਰੇ ਕਾਫੀ ਕੱਪੜੇ ਹੁੰਦੇ ਆ ਜਿਹੜੇ ਅਸੀਂ ਮਤਲਬ ਅਲੱਗ ਅਲੱਗ ਧੋਂਦੇ ਹਾਂ ਜਿੱਦਾਂ ਕਿ ਕਈ ਕੱਪੜਿਆਂ ਦੇ ਰੰਗ ਵੀ ਨਿਕਲਦੇ ਆ ਉਹਨਾਂ ਨੂੰ ਅਸੀਂ ਅਲੱਗ ਅਲੱਗ ਬਾਲਟੀ 'ਚ ਥੋੜ੍ਹਾ ਥੋੜ੍ਹਾ ਸਰਫ ਪਾ ਕੇ ਹੱਥਾਂ ਨਾਲ ਮਲ ਕੇ ਨਤਾਰ ਕੇ ਫੇਰ ਸਪਿੰਨ ਕਰਕੇ ਫਿਰ ਛੱਤ 'ਤੇ ਪਾ ਕੇ ਆਉਂਦੇ ਹਾਂ ਜੇ ਬਾਏ ਚਾਂਸ ਕਦੇ ਧੁੱਪ ਨਾ ਨਿਕਲੇ ਵੈਸੇ ਤਾਂ ਅਸੀਂ ਸਾਰੇ ਕੱਪੜੇ ਧੁੱਪੇ ਸਕਾਨੇ ਹਾਂ ਅਤੇ ਜਿੱਦਾਂ ਕਿ ਕਈ ਵਾਰ ਮੌਸਮ ਠੀਕ ਨਾ ਹੋਵੇ ਜਾਂ ਸਰਦੀਆਂ ਕਰਕੇ ਕੱਪੜੇ ਨਹੀਂ ਸੁੱਕਦੇ ਬਾਹਰ ਜਾਂ ਧੁੱਪ ਨਹੀਂ ਨਿਕਲਦੀ ਅਤੇ ਫਿਰ ਅਸੀਂ ਉਹ ਕੱਪੜਿਆਂ ਨੂੰ ਅਸੀਂ ਸਪਿਨਰ 'ਚੋਂ ਕੱਢ ਕੇ ਅਤੇ ਫਿਰ ਅਸੀਂ ਉਹ ਕੱਪੜਿਆਂ ਨੂੰ ਆਪਣੇ ਕਮਰੇ 'ਚ ਮਤਲਬ ਖਿਲਾਰ ਦੇਈਦਾ ਮੰਜੇ 'ਤੇ ਵਗੈਰਾ ਫਿਰ ਉਸ ਤੋਂ ਬਾਅਦ ਅਸੀਂ ਉਸ 'ਤੇ ਬਲੋਰ ਲਗਾ ਕੇ ਅਤੇ ਬਲੋਰ ਦੁਆਰਾ ਉਹਨਾਂ ਨੂੰ ਕੱਪੜਿਆਂ ਨੂੰ ਸੁਕਾਈਦਾ ਕਦੀ ਕਦੀ ਗਿੱਠੀ ਵੀ ਲੱਗੀ ਹੁੰਦੀ ਆ ਅਤੇ ਉਹਦੇ ਆਲੇ ਦੁਆਲੇ ਅਸੀਂ ਛੋਟੇ ਬੱਚਿਆਂ ਦੇ ਕੱਪੜੇ ਜਿੱਦਾਂ ਕੋਲ ਅੰਗੀਠੀ ਸੇਕਣ ਬੈਠਦੇ ਹਾਂ ਅਤੇ ਉਹ ਕੱਪੜੇ ਨੂੰ ਹੌਲੀ ਹੌਲੀ ਅਸੀਂ ਸੁਕਾ ਲੈਂਦੇ ਹਾਂ ਧੰਨਵਾਦ